ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਜੀ ਇਸ ਤਰ੍ਹਾਂ ਜੀ ਆਪਾਂ ਨੂੰ ਥੋੜ੍ਹੀ ਨਾ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਸੰਸਥਾ ਹੈਗੀ ਆ ਪਿੰਗਲਵਾੜਾ ਹਾਂਜੀ ਉਹਦੇ ਬਾਰੇ ਜਾਣਕਾਰੀ ਚਾਹੀਦੀ ਸੀ ਜੀ ਉਹ ਕੀ ਹੈਗਾ ਵਾ ਆਪਣਾ ਪਿਛਲਾ ਪਿੰਗਲਵਾੜੇ ਬਾਰੇ ਵੀ ਉਹ ਕੀ ਸੰਸਥਾ ਵਾ ਕੀ ਕਰਦੀ ਆ ਜਾਂ ਕਿੱਦਾ ਕੀ ਉਹਦਾ ਪਿਛਲਾ ਹਿਸਟਰੀ ਹੈਗੀ ਆ ਜੀ ਹਾਂਜੀ ਹਾਂਜੀ ਅੱਛਾ ਜੀ

ਠੀਕ ਹੈ

ਠੀਕ ਹੈ ਜੀ ਠੀਕ ਹੈ

ਹਾਂ ਜੀ

ਕਾਫ਼ੀ ਵੱ ਵੱਡੀ ਸੰਸਥਾ ਅੱਛਾ ਜੀ ਠੀਕ ਹੈ ਠੀਕ ਹੈ ਗਰੇਟ ਪਰਸਨ ਸੀ ਜੀ ਠੀਕ ਹੈ ਜੀ ਬਹੁਤ ਬਹੁਤ ਬਹੁਤ ਠੀਕ ਹੈ ਬਹੁਤ ਗਰੇਟ ਪਰਸਨ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਹਨਾ ਦੇ ਬਾਰੇ ਬਹੁਤ ਧੰਨਵਾਦ ਜੀ